ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਮੁੱਖ ਸੱਭਿਆਚਾਰਕ ਅੰਤਰ ਹਨ ਜਿੱਦਾਂ ਉੱਤਰੀ ਇਲਾਕੇ ਵਿੱਚ ਠੰਡੇ ਠੰਡ ਹੁੰਦੀ ਹੈ ਅਤੇ ਦੱਖਣੀ ਵਿੱਚ ਗਰਮੀ ਹੁੰਦੀ ਹੈ ਜਿਸ ਕਰਕੇ ਉੱਤਰੀ ਭਾਰਤ ਦੇ ਵਿੱਚ ਭੋਜਨ ਕੱਪੜੇ ਭਾਸ਼ਾਵਾਂ ਆਦਿ ਥੋੜ੍ਹਾ ਸਾ ਅਲੱਗ ਹੁੰਦੇ ਹੈ ਅਤੇ ਹੋਰ ਵੀ ਮੌਸਮ ਵੀ ਕਾਫ਼ੀ ਤਰ੍ਹਾਂ ਦੇ ਚੇਂਜ ਹੁੰਦੇ ਹਨ ਅਤੇ ਉਸ ਤਰ੍ਹਾਂ ਦਾ ਖਾਣਾ ਪੀਣਾ ਵੀ ਹੁੰਦਾ ਹੈ ਅਤੇ ਦੱਖਣੀ ਭਾਰਤ ਦੇ ਵਿੱਚ ਫ਼ਸਲਾਂ ਆਦਿ ਹੁੰਦੀਆਂ ਹਨ ਅਤੇ ਉੱਧਰ ਦੇ ਲੋਕ ਭੋਜਨ ਜ਼ਿਆਦਾ ਖਾਣਾ ਪ ਪਸੰਦ ਕਰਦੇ ਹਨ